ਮੈਨੂੰ ਤਾਂ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਅੱਜ ਕੱਲ ਦੇ ਆਧੁਨਿਕ ਯੁੱਗ ਦੇ ਵਿੱਚ ਵੀ ਸਾਡੀ ਨੌਜਵਾਨ ਪੀੜੀ ਭੰਗੜੇ ਦੇ ਨਾਲ ਜੁੜਨਾ ਬਹੁਤ ਪਸੰਦ ਕਰ ਰਹੀ ਹੈ ਕੁਝ ਸਮੇਂ ਪਹਿਲੇ ਭੰਗੜੇ ਵੱਲੋਂ ਅੱਜ ਦੀ ਨੌਜਵਾਨ ਪੀੜੀ ਦਾ ਰੁਝਾਨ ਖਤਮ ਹੋ ਗਿਆ ਸੀ ਤੇ ਉਹ ਵਿਦੇਸ਼ੀ ਗਾਣੇ ਸੁਣ ਸੁਣ ਕੇ ਨੱਚਣਾ ਤੇ ਉਹਨਾਂ ਤੇ ਟਪਣਾ ਬਹੁਤ ਪਸੰਦ ਕਰਦੇ ਸਨ ਪਰ ਹੁਣ ਕਾਫੀ ਸਮੇਂ ਤੋਂ ਮੈਂ ਇਹ ਦੇਖਿਆ ਹੈ ਕਿ ਅੱਜ ਦੀ ਪੀੜੀ ਭੰਗੜੇ ਦੇ ਵਿੱਚ ਤੇ ਆਪਣੇ ਪੰਜਾਬੀ ਸੱਭਿਆਚਾਰ ਦੇ ਵਿੱਚ ਬਹੁਤ ਜਿਆਦਾ ਰੁੱਝ ਰਹੀ ਹੈ ਇਹ ਭੰਗੜਾ ਜੇ ਦੇਖਿਆ ਜਾਵੇ ਤਾਂ ਸਾਡੇ ਪੰਜਾਬ ਦਾ ਹੀ ਇੱਕ ਬਹੁਤ ਵਧੀਆ ਸੱਭਿਆਚਾਰਕ ਨਾਚ ਦਾ ਇੱਕ ਤਰੀਕਾ ਹੈ ਆਪਣੀ ਖੁਸ਼ੀ ਨੂੰ ਜਾਹਿਰ ਕਰਨ ਦਾ ਤੇ ਇਹ ਸੱਭਿਆਚਾਰਕ ਵਿਸ ਵਿਰਾਸਤ ਅਪਨਾਣ ਨੂੰ ਸਾਡੀ ਨੌਜਵਾਨ ਪੀੜੀ ਅੱਜ ਕੱਲ ਬਹੁਤ ਯਤਨ ਕਰ ਰਹੀ ਹੈ ਮੈਂ ਇਹ ਵੀ ਦੇਖਿਆ ਹੈ ਕਿ ਹੁਣ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਹੋਰ ਕਈ ਅਜਿਹੇ ਨੌਜਵਾਨ ਹਨ ਜੋ ਕਿ ਵਿਦੇਸ਼ੀ ਸੰਸਥਾਵਾਂ ਨਾਲ ਜੁੜੇ ਹਨ ਪਰ ਉਹ ਵੀ ਸਾਡੇ ਭੰਗੜੇ ਨੂੰ ਅੱਗੇ ਲਿਆਣ ਦੇ ਵਿੱਚ ਕੋਸ਼ਿਸ਼ ਕਰ ਰਹੇ ਹਨ ਇਹ ਜਿਹੜਾ ਸਾਡਾ ਪੰਜਾਬੀ ਭੰਗੜਾ ਹੈ ਇਹ ਸਿਹਤ ਦੇ ਲਈ ਜਾਂ ਬਹੁਤ ਹੀ ਚੰਗਾ ਹੈ ਸਾਨੂੰ ਚੁਸਤ ਤੰਦਰੁਸਤ ਰੱਖਦਾ ਹੈ ਤੇ ਨਾਲ ਹੀ ਸਾਡੇ ਸੱਭਿਆਚਾਰ ਨੂੰ ਵੀ ਬਚਾਉਣ ਦੇ ਵਿੱਚ ਇੱਕ ਬਹੁਤ ਵੱਡਾ ਸਹਾਇਕ ਸਿੱਧ ਹੈ ਤੇ ਮੈਂ ਅਰੋਬਿਕ ਦੇ ਤੇ ਭੰਗੜੇ ਦੇ ਵਾਧੇ ਤੇ ਵਿਕਾਸ ਵਿੱਚ ਹੁਣ ਇਹ ਇਕ ਨਵਾਂ ਉਪਰਾਲਾ ਵਰਤਿਆ ਹੈ ਮੈਨੂੰ ਤੇ ਪੰਜਾਬੀ ਭੰਗੜੇ ਦਾ ਬਹੁਤ ਸ਼ੌਂਕ ਹੈ ਮੈਂ ਹੁਣ ਇੱਕ ਅਜਿਹਾ ਸੰਸਥਾਨ ਖੋਲਣਾ ਚਾਹੁੰਦੀ ਹਾਂ ਜਿਹਦੇ ਵਿੱਚ ਨੌਜਵਾਨਾਂ ਨੂੰ ਇਸ ਚੀਜ਼ ਦੇ ਵੱਲ ਉਹਨਾਂ ਦਾ ਧਿਆਨ ਦਵਾਇਆ ਜਾਵੇ ਤੇ ਉਹਨਾਂ ਨੂੰ ਆਪਣੀ ਵਿਰਾਸਤ ਦੇ ਨਾਲ ਜੋੜਿਆ ਜਾ ਸਕੇ ਧੰਨਵਾਦ